ਪੰਜਾਬ ਵਿੱਚ ਬਹੁਤ ਸਾਰੇ ਲੋਕ ਹਨ ਜਿਹਨਾਂ ਨੇ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ ਹੋਇਆ ਹੈ ਜੋ ਕਿ ਆਪਣੀ ਘਰ ਵਿੱਚ ਬੈਠੇ ਹੀ ਆਪਣੇ ਕਈ ਤਰ੍ਹਾਂ ਦੀਆਂ ਹੱਥਾਂ ਨਾਲ ਵਸਤੂਆਂ ਬਣਾ ਕੇ ਵੇਚਦੇ ਹਨ ਬੈਂਕ ਸਰਕਾਰ ਵੱਲੋਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਜਿਹਨਾਂ ਲੋਕਾਂ ਦਾ ਆਰਟ ਐਂਡ ਕਰਾਫਟ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ ਸਬਸਿਡੀ ਵੀ ਮਿਲਦੀ ਹੈ ਅਤੇ ਲੋਨ ਵੀ ਜਲਦੀ ਹੀ ਦਿੱਤਾ ਜਾਂਦਾ ਹੈ ਜੋ ਕਿ ਆਪਣਾ ਬੈਂਕ ਤੋਂ ਲੋਨ ਲੈ ਕੇ ਲੋਕ ਆਪਣਾ ਬਿਜਨਸ ਘਰ ਬੈਠੇ ਹੀ ਸਟਾਰਟ ਕਰ ਸਕਦੇ ਹਨ ਜਿਹੜੀਆਂ ਇਹ ਖਪਤਕਾ ਆਸ਼ ਕਲਾਕਾਰੀ ਸ਼ਿਲਪਕਾਰੀ ਦੀਆਂ ਚੀਜ਼ਾਂ ਹੁੰਦੀਆਂ ਹਨ ਇਹਨਾਂ ਦੀ ਮੰਗ ਤਿਉਹਾਰਾਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਈ ਲੋਕ ਆਪਣੇ ਘਰਾਂ ਦੀ ਸਜਾਵਟ ਲਈ ਇਹਨਾਂ ਚੀਜ਼ਾਂ ਦੀ ਮੰਗ ਕਰਦੇ ਹਨ ਜੋ ਕਿ ਆਪਣੇ ਹੱਥ ਦੀ ਬਣਾਈ ਚੀਜ਼ ਬਹੁਤ ਹੀ ਵਧੀਆ ਅਤੇ ਸੁੰਦਰ ਹੁੰਦੀ ਹੈ ਫੈਕਟਰੀਆਂ ਵਿੱਚ ਇੱਕ ਚੀਜ਼ ਦੀ ਹੀ ਕਾਪੀ ਵਾਰ ਵਾਰ ਕੀਤੀ ਜਾਂਦੀ ਹੈ ਘਰ ਵਿੱਚ ਲੋਕ ਬੈਠ ਕੇ ਬੜੀ ਵੀ ਸੁੰਦਰਤਾ ਨਾਲ ਸਜਾਵਟ ਵਾਲੀਆਂ ਚੀਜ਼ਾਂ ਸ਼ਿਲਪਕਾਰ ਤਿਆਰ ਕਰਦੇ ਹਨ ਸ ਕਈ ਲੋਕ ਐਗਜ਼ੀਬਿਸ਼ਨ ਵੀ ਲਾਉਂਦੇ ਹਨ ਜਿਸ ਵਿੱਚ ਕਿਸੇ ਦੀ ਵੀ ਮਦਦ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਪਣੀ ਪ੍ਰਦਰਸ਼ਨੀ ਆਪਣੀ ਚੀਜ਼ ਦੀ ਖੁਦ ਕਰ ਸਕਦੇ ਹਨ ਉਹਨਾਂ ਨੂੰ ਆਪਣੀ ਚੀਜ਼ ਦਾ ਪੂਰਾ ਮੁੱਲ ਵੀ ਮਿਲ ਜਾਂਦਾ ਹੈ ਕਈ ਲੋਕ ਇਹ ਚੀਜ਼ਾਂ ਨੂੰ ਆਪਣੇ ਘਰ ਵਿੱਚ ਬਣਾ ਕੇ ਆਨਲਾਈਨ ਵੀ ਸੇਲ ਕਰਦੇ ਹਨ ਜੋ ਕਿ ਬਹੁਤ ਹੀ ਵਧੀਆ ਕੰਮ ਹੈ ਜੋ ਕੀ ਛੋਟੇ ਕਾਰੀਗਰ ਹੁੰਦੇ ਹਨ ਆਨਲਾਈਨ ਉਹਨਾਂ ਦਾ ਕੰਮ ਬਹੁਤ ਵਧੀਆ ਚੱਲ ਜਾਂਦਾ ਹੈ ਉਹਨਾਂ ਸਾਨੂੰ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਤੋਂ ਚੀਜ਼ਾਂ ਖਰੀਦਣ ਦੀ ਬਜਾਏ ਛੋਟੀ ਕਾਰੀਗਰਾਂ ਤੋਂ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਤਾਂ ਕਿ ਉਹਨਾਂ ਦਾ ਆਪਣਾ ਕੰਮ ਵੀ ਬਹੁਤ ਵਧੀਆ ਚਲ ਚਲ ਸਕੇ ਘਰ ਦੀ ਬਣਾਈ ਜੀ ਘਰ ਦੀ ਹੱਥਾਂ ਨਾਲ ਬਣਾਈ ਚੀਜ਼ ਫੈਕਟਰੀ ਦੀ ਬਣਾਈ ਚੀਜ਼ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਜੋ ਕਿ ਅਸੀਂ ਹੱਥ ਨਾਲ ਚੀਜ਼ ਬਣਾਉਂਦੇ ਹਾਂ ਉਹ ਬਹੁਤ ਜ਼ਿਆਦਾ ਵਧੀਆ ਚੀਜ਼ ਬਣਦੀ ਹੈ ਫੈਕਟਰੀ ਵਿੱਚ ਤਾਂ ਇੱਕ ਤਰ੍ਹਾਂ ਦੀ ਕਈ ਕੀ ਪੀਸ ਕਾਪੀ ਕਰ ਕਰਕੇ ਬਣਾਏ ਜਾਂਦੇ ਹਨ ਜੋ ਕਿ ਸੇਮ ਹੀ ਬਣ ਜਾਂਦੇ ਹਨ ਇਸ ਲਈ ਸਾਨੂੰ ਜੋ ਘਰ ਵਿੱਚ ਛੋਟੇ ਕਾਰੀਗਰ ਹਨ ਆਪਣੇ ਘਰ ਚੀ ਸਮਾਨ ਬਣਾਉਂਦੇ ਹਨ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਉਹਨਾਂ ਕੋਲੋਂ ਸਾਨੂੰ ਸਜਾਵਟ ਲਈ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਸ਼ਿਲਪਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ